ਪਹਿਲਾਂ ਦੇ ਸਮੇਂ ਵਿੱਚ ਔਨਲਾਈਨ ਦਾ ਇੱਕ ਕੋਈ ਵੀ ਇੱਦਾਂ ਦਾ ਰੋਲ ਨਹੀਂ ਸੀ ਹੁਣ ਅੱਜ ਅੱਜ ਦੇ ਸਮੇਂ ਵਿੱਚ ਔਨਲਾਈਨ ਜਿਹੜਾ ਹੈ ਉਹ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਬਣ ਗਿਆ ਏ ਜਿਵੇਂ ਕਿ ਅਸੀਂ ਗੱਲ ਕਰੀਏ ਤਾਂ ਕਰੋਨਾ ਦੇ ਟਾਈਮ ਦੀ ਕਰੋਨਾ ਦੇ ਸਮੇਂ ਮਤਲਬ ਔਨਲਾਈਨ ਨੇ ਬੱਚਿਆਂ ਦੀ ਜ਼ਿੰਦਗੀ 'ਚ ਜੀਵਨ 'ਚ ਇੱਕ ਬਹੁਤ ਹੀ ਮਹੱਤਵਪੂਰਨ ਰੋਲ ਨਿਭਾਇਆ ਜਿੱਦਾਂ ਹੁਣ ਕਰੋਨਾ ਦੇ ਸਮੇਂ ਜਦ ਸਕੂਲ ਬੰਦ ਹੋ ਗਏ ਸਭ ਕੁਛ ਬੰਦ ਹੋ ਗਿਆ ਸੀ ਤਾਂ ਬੱਚਿਆਂ ਦੀ ਜਿਹੜਾ ਜੀਵਨ ਸੀ ਉਹ ਕਾਫੀ ਮਤਲਬ ਉਹ ਹੋ ਜਾਣਾ ਤਾ ਜਿੱਦਾਂ ਕਿ ਹੁਣ ਗੱਲ ਕਰੀਏ ਔਨਲਾਈਨ ਕਰਕੇ ਉਹਨਾਂ ਦਾ ਪੜ੍ਹਾਈ ਵੀ ਨਹੀਂ ਰੁਕਿਆ ਅਤੇ ਬੱਚੇ ਹੁਣ ਆਪਣਾ ਪੜ੍ਹਾਈ ਵੀ ਪੂਰਾ ਕਰ ਚੁੱਕੇ ਹਨ ਜਿੱਦਾਂ ਹੁਣ ਔਨਲਾਈਨ ਕਰਕੇ ਔਨਲਾਈਨ ਜੇ ਨਹੀਂ ਹੁੰਦਾ ਜਿੱਦਾਂ ਸਕੂਲ ਬੰਦ ਹੋ ਗਿਆ ਸੀ ਜੇ ਔਨਲਾਈਨ ਨਹੀਂ ਹੁੰਦਾ ਤਾਂ ਉਹ ਬੰਦ ਹੋ ਜਾਣਾ ਤਾ ਜਿੱਦਾਂ ਹੁਣ ਤਾਂ ਸਮੇਂ ਇੱਦਾਂ ਦਾ ਏ ਕਿ ਬੰਦ ਹੋ ਬੰਦ ਨਹੀਂ ਹੋਇਆ ਔਨਲਾਈਨ ਕਰਕੇ ਕਾਫੀ ਬ ਬੱਚਿਆਂ ਦੀ ਜ਼ਿੰਦਗੀ 'ਚ ਮਹੱਤਵਪੂਰਨ ਰਿਹਾ ਉਨ ਜੀ ਜਿੱਦਾਂ ਜੇ ਕੋਚਿੰਗ ਬੰਦ ਹੋ ਜਾਣਾ ਤਾ ਤਾਂ ਬੱਚਿਆਂ ਦੇ ਪੜ੍ਹਾਈ ਦਾ ਵੀ ਕਾਫੀ ਰੁੱਕ ਜਾਣਾ ਤਾ ਜਿੱਦਾਂ ਹੁਣ ਮੈਂ ਵੀ ਆਪਣੀ ਜੇ ਗੱਲ ਕਰਾਂ ਤਾਂ ਮੈਂ ਵੀ ਕੋਚਿੰਗ ਲੈਂਦੀ ਹਾਂ ਜਿੱਦਾਂ ਹੁਣ ਮੈਂ ਕੁਛ ਟਾਈਮ ਕੁਛ ਸਮੇਂ ਆਪਣਾ ਜੋਬ ਵੀ ਕਰ ਲੈਂਦੀ ਹਾਂ ਅਤੇ ਘਰ ਆ ਕੇ ਕੋਚਿੰਗ ਔਨਲਾਈਨ ਜਿੱਦਾਂ ਪੜ੍ਹ ਲੈਂਦੀ ਹਾਂ ਅਤੇ ਔਨਲਾਈਨ ਜਿਹੜਾ ਹੈ ਉਹ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਏ ਬੱਚਿਆਂ ਦੀ ਉਹਨਾਂ ਨੇ ਔਨਲਾਈਨ ਨੇ ਬੱਚਿਆਂ ਦੀ ਜ਼ਿੰਦਗੀ ਬਹੁਤ ਹੀ ਵਧੀਆ ਬਣਾ ਤੀ